ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਵਿਆਹ ਸ਼ਾਦੀਆਂ ਮੇਲੇ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ ਉਹਨਾਂ ਵਿੱਚੋਂ ਜਨਮ ਦਿਨ ਵੀ ਉਹ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ ਅਤੇ ਵਿਆਹ ਸ਼ਾਦੀਆਂ ਵੀ ਬਹੁਤ ਹੀ ਜ਼ਿਆਦਾ ਧੂਮ ਧਾਮ ਨਾਲ ਕਰਦੇ ਹਨ ਜੇਕਰ ਦੇਖਿਆ ਜਾਏ ਤਾਂ ਜਨਮ ਦਿਨ ਪਿਛਲੇ ਹਫਤੇ ਮੇਰੀ ਮਾਸੀ ਦੇ ਮੁੰਡੇ ਦਾ ਜਨਮ ਦਿਨ ਸੀ ਅਸੀਂ ਸਾਰੇ ਜਾਣੇ ਉੱਥੇ ਗਏ ਹੋਏ ਸੀ ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ ਸੀ ਸਭ ਤੋਂ ਪਹਿਲਾਂ ਉੱਥੇ ਕੇਕ ਕਟਿੰਗ ਹੋਈ ਸੀ ਅਸੀਂ ਉਹਨੂੰ ਵਿਸ਼ਿਸ਼ ਦਿੱਤੀਆਂ ਸੀਗੀਆਂ ਅਤੇ ਫਿਰ ਹੋਰ ਵੀ ਬਹੁਤ ਹੀ ਵਧੀਆ ਖਾਣ ਪੀਣ ਦਾ ਸਮਾਨ ਵੀ ਖਾਧਾ ਸੀ ਅਤੇ ਜੇਕਰ ਵਿਆਹ ਨੂੰ ਦੇਖਿਆ ਜਾਏ ਵਿਆਹ ਵੀ ਪੰਜਾਬੀ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ ਵਿਆਹ ਵਿੱਚ ਨਾਨਕਾ ਮੇਲ ਆ ਵਿਆਹ ਵਿੱਚ ਨਾਨਕਾ ਮੇਲ ਆਉਂਦਾ ਹੈ ਅਤੇ ਨਿਆਣਕੇ ਮੇਲ ਵੱਲੋਂ ਲਿਆਉਂਦੀਆਂ ਚੀਜ਼ਾਂ